ਪੰਜਾਬ ਦੇ ਵਿੱਚ ਆਵਾਜਾਈ ਦੇ ਰਵਾਇਤੀ ਢੰਗ ਜ਼ਿਆਦਾਤਰ ਜਾਨਵਰਾਂ ਨਾਲ ਹੀ ਸੰਬੰਧਿਤ ਹਨ ਘੋੜਿਆਂ ਨਾਲ ਟਾਂਗੇ ਚੱਲਦੇ ਸੀ ਬਲਦਾਂ ਨਾਲ ਗੱਡੇ ਬੰਨ੍ਹ ਕੇ ਬੈਲ ਗੱਡੀਆਂ ਚੱਲਦੀਆਂ ਸੀਗੀਆਂ ਜਾਂ ਰਾਜੇ ਮਹਾਰਾਜੇ ਜੰਗਾਂ ਵੇਲੇ ਜਾਂ ਆਮ ਕਰਕੇ ਹਾਥੀ ਵਰਤਦੇ ਸੀ ਲੋਕ ਵੀ ਆਮ ਹਾਥੀ ਜੇ ਜੰਗਲੋ ਜੰਗਲੀ ਜ਼ਿਆਦਾ ਮਿਲਣ ਤਾਂ ਹਾਥੀਆਂ ਨੂੰ ਹਾਥੀਆਂ 'ਤੇ ਚੜ੍ਹ ਕੇ ਵਰਤਦੇ ਸੀ ਅਤੇ ਬਾਕੀ ਹੋਰ ਦੇਖਿਆ ਜਾਵੇ ਤਾਂ ਡੋਲੀਆਂ ਵੀ ਹੁੰਦੀਆਂ ਸੀਗੀਆਂ ਜਦੋਂ ਵਿਆਹ ਵੇਲੇ ਕੁੜੀ ਨੂੰ ਘੱਲਣਾ ਏ ਤਾਂ ਡੋਲ ਡੋਲੀ ਦੇ ਵਿੱਚ ਬਿਠਾ ਕੇ ਅਤੇ ਜਿਹੜਾ ਲਾੜਾ ਏ ਅਤੇ ਉਹ ਉਹ ਘੋੜੇ ਦੇ ਉੱਤੇ ਘੋੜੀ ਉੱਤੇ ਚੜ੍ਹ ਕੇ ਆਉਂਦਾ ਸੀ ਕਈ ਜਗ੍ਹਾ ਗਧੇ ਵੀ ਵਰਤੇ ਜਾਂਦੇ ਰਹੇ ਆ ਕਈ ਸਮਿਆਂ 'ਚ ਅਤੇ ਹੁਣ ਸਮੇਂ ਦੇ ਵਿਕਸਿਤ ਹੋਣ ਨਾਲ ਫਿਰ ਸਾਈਕਲ ਆਏ ਸਾਈਕਲਾਂ ਤੋਂ ਬਾਅਦ ਲੌਰੀਆਂ ਆਈਆਂ ਬੱਸਾਂ ਕਾਰਾਂ ਆ ਗਈਆਂ ਰੇਲ ਗੱਡੀਆਂ ਆਈਆਂ ਜਹਾਜ ਆ ਗਏ ਹੁਣ ਜ਼ਿਆਦਾਤਰ ਮੌਜੂਦਾ ਰੁਝਾਨ ਜਾਂ ਤਾਂ ਲੋਕ ਬੱਸਾਂ ਵਰਤਦੇ ਹਨ ਜਿਹੜੀਆਂ ਪਬਲਿਕ ਟਰਾਂਸਪੋਰਟੇਸ਼ਨ ਦੇ ਅੰਦਰ ਆਉਂਦੀਆਂ ਨਹੀਂ ਤਾਂ ਲੋਕ ਸਾਈਕਲ ਚਲਾਉਣਾ ਪਸੰਦ ਕਰਦੇ ਹਨ ਜੇ ਆਪਣੇ ਸ਼ਹਿਰ ਦੇ ਅੰਦਰ ਅੰਦਰ ਤੱਕ ਹੀ ਰਹਿਣਾ ਪ੍ਰਦੂਸ਼ਣ ਵੀ ਘੱਟਦਾ ਉਹਦੇ ਨਾਲ ਜਿੱਦਾਂ ਮੈਂ ਫਤਿਹਗੜ੍ਹ ਸਾਹਿਬ ਰਹਿੰਦੀ ਹਾਂ ਅਤੇ ਇੱਥੇ ਜ਼ਿਆਦਾਤਰ ਲੋਕ ਸਾਈਕਲ ਚਲਾਉਣਾ ਪਸੰਦ ਕਰਦੇ ਆ ਸਵੇਰੇ ਅਤੇ ਸ਼ਾਮ ਆਉਣ ਜਾਣ ਲਈ ਸ਼ਹਿਰ ਸ਼ਹਿਰ ਦੇ ਅੰਦਰ ਅਤੇ ਬਾਹਰ ਜਾਣਾ ਹੋਵੇ ਤਾਂ ਸਕੂਟਰ ਮੋਟਰਸਾਈਕਲ ਕਾਰਾਂ ਵਰਤਦੇ ਆ ਜਦੋਂ ਅੰਗਰੇਜ਼ ਆਏ ਅਸਲ ਦੇ ਵਿੱਚ ਉਦੋਂ ਰੇਲ ਗੱਡੀਆਂ ਰੇਲ ਗੱਡੀਆਂ ਸ਼ੁਰੂ ਹੋਈਆਂ ਮੋਟਰ ਵਾਲੀਆਂ ਲੋਰੀਆਂ ਆ ਗਈਆਂ ਤਾਂ ਜਿਹੜੇ ਪੁਰਾਣੇ ਸਾਧਨ ਸੀਗੇ ਟਾਂਗਾ ਬੈਲ ਗੱਡੀਆਂ ਇਹ ਸਭ ਵਰਤੋਂ ਦੇ ਵਿੱਚੋਂ ਬਾਹਰ ਹੁੰਦੇ ਗਏ ਫਿਰ ਹੌਲੀ ਹੌਲੀ ਸਕੂਟਰਾਂ ਨੇ ਅਤੇ ਸਾਈਕਲਾਂ ਨੇ ਇਹ ਇਹਨਾਂ ਦਾ ਇਹਨਾਂ ਦੇ ਅੰਦਰ ਰੁਝਾਨ ਵੱਧ ਗਿਆ ਅਤੇ ਫਿਰ ਹੁਣ ਪਿੱਛੇ ਜੇ ਪਿੱਛੇ ਦਸ ਸਾਲਾਂ ਤੋਂ ਪਿਛਲੇ ਪੰਦਰ੍ਹਾਂ ਵੀਹ ਸਾਲਾਂ ਤੋਂ ਖਾਸਕਰ ਕਾਰਾਂ ਜਿਹੜੀਆਂ ਇਹ ਜ਼ਿਆਦਾ ਵਰਤੋਂ 'ਚ ਆਉਣ ਲੱਗ ਗਈਆਂ ਪਹਿਲਾਂ ਲਾਰੀਆਂ ਹੁੰਦੀਆਂ ਸੀ ਹੁਣ ਕਾਰਾਂ ਅਤੇ ਅੱਜ ਕੱਲ੍ਹ ਜ਼ਿਆਦਾਤਰ ਫਿਰ ਲੋਕ ਬੱਸਾਂ ਕਾਰਾਂ ਦੇ ਵਿੱਚ ਹੀ ਆਉਣਾ ਜਾਣਾ ਚੰਗਾ ਸਮਝਦੇ ਹਨ ਅਤੇ ਮੌਜੂਦਾ ਹਾਲਾਤਾਂ ਦੇ ਵਿੱਚ ਬੱਸਾਂ ਕਾਰਾਂ ਹੀ ਹਮੇਸ਼ਾਂ ਜ਼ਿਆਦਾਤਰ ਵਰਤੀਆਂ ਜਾਂਦੀਆਂ ਹਨ